ਹੈਲੋ ਮੀਸ਼ੋ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ ਮੈਂ ਤੁਹਾਡੇ ਤੋਂ ਜੋ ਕੁੜਤੀ ਮੰਗਵਾਈ ਸੀ ਉਹ ਬਹੁਤ ਹੀ ਜ਼ਿਆਦਾ ਵਧੀਆ ਨਿਕਲੀ ਮੈਂ ਉਸ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਜਦੋਂ ਮੈਂ ਉਹ ਮੰਗਵਾਈ ਤਾਂ ਪਹਿਲਾਂ ਤਾਂ ਉਹ ਸਹੀ ਸਮੇਂ 'ਤੇ ਪਹੁੰਚੀ ਮੈਨੇ ਆਪਣੇ ਜਨਮਦਿਨ ਵਾਲੇ ਦਿਨ ਉਹ ਕੁੜਤੀ ਪਹਿਨੀ ਜਿਸ ਦਾ ਅੱਜ ਕੱਲ੍ਹ ਬਹੁਤ ਰਿਵਾਜ਼ ਚੱਲ ਰਿਹਾ ਹੈ ਅਤੇ ਸਭ ਨੂੰ ਉਹ ਬਹੁਤ ਪਸੰਦ ਆਈ ਸਭ ਨੇ ਉਸ ਦੀ ਬਹੁਤ ਤਾਰੀਫ਼ ਕੀਤੀ ਉਸ ਦਿਨ ਮੇਰੇ ਬਰਥਡੇ ਉੱਪਰ ਮੇਰੀਆਂ ਸਹੇਲੀਆਂ ਨੇ ਕੇਕ ਵਗੈਰਾ ਲਗਾ ਦਿੱਤਾ ਸੀ ਕੁੜਤੀ ਦੇ ਉੱਪਰ ਜਿਸ ਨੂੰ ਧੋਣ ਤੋਂ ਬਾਅਦ ਉਹ ਬਹੁਤ ਹੀ ਵਧੀਆ ਨਿਕਲੀ ਨਾ ਤਾਂ ਉਹ ਸ਼ਰਿੰਕ ਹੋਈ ਨਾ ਹੀ ਉਸ ਦਾ ਕਲਰ ਉੱਤਰਿਆ ਅਤੇ ਨਾ ਹੀ ਉਸ ਦੀ ਕੋਈ ਇਮਬੋਇਡਰੀ ਖਰਾਬ ਹੋਈ ਮੈਂ ਆਪਣੀ ਸਾਰੇ ਰਿਸ਼ਤੇਦਾਰ ਸਹੇਲੀਆਂ ਨੂੰ ਉਸ ਦੇ ਬਾਰੇ ਦੱਸਿਆ ਤਾਂ ਸਾਰੇ ਉਸ ਦਾ ਪ੍ਰਾਈਜ਼ ਜਾਣ ਕੇ ਬਹੁਤ ਹੈਰਾਨ ਹੋਏ ਕਿਉਂਕਿ ਜਦੋਂ ਮੈਂ ਉਹ ਲਈ ਸੀ ਤਾਂ ਉਸ ਸਮੇਂ ਮੀਸ਼ੋ ਦੇ ਉੱਪਰ ਬਹੁਤ ਵਧੀਆ ਸੇਲ ਚੱਲ ਰਹੀ ਸੀ ਮੈਂ ਬਹੁਤ ਖੁਸ਼ ਹਾਂ ਕਿ ਤੁਹਾਨੂੰ ਤੁਸੀਂ ਮੈਨੂੰ ਐਨਾ ਵਧੀਆ ਪ੍ਰੋਡਕਟ ਦਿੱਤਾ ਇਸ ਦੇ ਨਾਲ ਹੀ ਮੈਂ ਅੱਗੇ ਤੋਂ ਜੋ ਵੀ ਸਮਾਨ ਮੰਗਵਾਵਾਂਗੀ ਮੀਸ਼ੋ ਤੋਂ ਬਹੁਤ ਹੀ ਜਲਦੀ ਹੋਰ ਵੀ ਓਡਰ ਦੇਵਾਂਗੀ ਅਤੇ ਮੈਂ ਆਪਣੀ ਨਾਲ ਦੀਆਂ ਸਹੇਲੀਆਂ ਸਾਥੀਆਂ ਨੂੰ ਵੀ ਇਸਦੇ ਬਾਰੇ ਦੱਸਿਆ ਹੈ